ਮੈਂ ਆਪਣੇ ਮੋਬਾਈਲ ਦਾ ਖਰਚਾ ਘਟਾਉਣਾ ਚਾਹੁੰਦਾ ਹਾਂ ਮੇਰੇ ਪਰਿਵਾਰ ਦੇ ਵਿੱਚ ਬਹੁਤ ਮੈਂਬਰ ਨੇ ਅਤੇ ਉਹਨਾਂ ਦਾ ਸਾਰਿਆਂ ਦਾ ਖਰਚਾ ਮਿਲਾ ਕੇ ਬਹੁਤ ਮੋਬਾਈਲ ਦਾ ਖਰਚਾ ਮਿਲਾ ਕੇ ਬਹੁਤ ਹੀ ਵੱਧ ਜਾਂਦਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਇਹ ਖਰਚਾ ਘੱਟ ਤੋਂ ਘੱਟ ਹੋਵੇ ਜਿਸ ਨਾਲ ਕਿ ਮੈਂ ਜਿਹੜਾ ਉਹ ਪੈਸੇ ਬਚਾ ਕੇ ਕਿਸੇ ਵਧੀਆ 'ਚ ਜਗ੍ਹਾ 'ਤੇ ਇਨਵੈਸਟ ਕਰ ਸਕਾਂ ਹੁਣ ਜਿਸ ਤਰ੍ਹਾਂ ਟੈਲੀਫੋਨ ਕੰਪਨੀਆਂ ਦੇ ਰੇਟ ਵਧੇ ਨੇ ਜਿਸ ਨਾਲ ਮੇਰੇ ਸਾਡੇ ਪਰਿਵਾਰ ਦਾ ਜਿਹੜਾ ਮੋਬਾਈਲ ਉੱਪਰ ਖਰਚਾ ਹੈ ਉਹ ਵੱਧ ਗਿਆ ਹੈ ਅਤੇ ਮੈਂ ਇਸ ਨੂੰ ਹੁਣ ਚਾਹੁੰਦਾ ਹਾਂ ਕਿ ਮੈਂ ਇਸ ਨੂੰ ਕਿਸ ਤਰ੍ਹਾਂ ਘੱਟ ਕਰ ਸਕਾਂ ਮੈਂ ਚਾਹੁੰਦਾ ਹਾਂ ਕਿ ਮੈਨੂੰ ਇਸ ਦੇ ਹੋਰ ਵਿਕਲਪਾਂ ਬਾਰੇ ਪਤਾ ਲੱਗੇ ਕਿ ਹੋਰ ਹੋਰ ਹੋਰ ਕਿਹੜੀਆਂ ਕੰਪਨੀਆਂ ਜਿਹੜੀਆਂ ਘੱਟ ਘੱਟ ਦਰਾਂ 'ਤੇ ਇਹ ਸਰਵਿਸ ਪ੍ਰੋਵਾਈਡ ਕਰ ਕਰਵਾਉਂਦੀਆਂ ਹਨ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪਤਾ ਕਰਨਾ ਪੈਣਾ ਅਤੇ ਫਿਰ ਮੈਂ ਉਸ ਚੀਜ਼ਾਂ ਬਾਰੇ ਸੋਚ ਕੇ ਸੋਚ ਵਿਚਾਰ ਕੇ ਆਪਣੇ ਮੋਬਾਈਲ ਦੇ ਖਰਚੇ ਘਟਾਉਣ ਬਾਰੇ ਸੋਚੂਗਾ